ਸਾਡੇ ਦੇਸ਼ ਵਿੱਚ ਹਸਪਤਾਲ ਅਤੇ ਡਾਕਟਰਾਂ ਦੀ ਸਰਕਾਰੀ ਡਾਕਟਰਾਂ ਦੀ ਘਾਟ ਹੈਗੀ ਆ ਪਿੰਡਾਂ 'ਚ ਅਤੇ ਹਸਪਤਾਲਾਂ ਦੀ ਵੀ ਘਾਟ ਹੈਗੀ ਅਤੇ ਵੀ ਪਰ ਅੱਗੇ ਨਾਲੋਂ ਤਾਂ ਬਿਹਤਰ ਹੋ ਗਏ ਵੀ ਹਸਪਤਾਲਾਂ ਦੇ ਵਿੱਚ ਹੀ ਦਵਾਈ ਮਿਲਣ ਲੱਗ ਗਈ ਮਰੀਜ਼ਾਂ ਨੂੰ ਪਹਿਲਾਂ ਮਰੀਜ਼ਾਂ ਨੂੰ ਮੈਡੀਕਲਾਂ 'ਤੇ ਬਾਹਰ ਜਾਣਾ ਪੈਂਦਾ ਸੀ ਅਤੇ ਉਹ ਮੈਡੀਕਲ ਵਾਲਿਆਂ ਨਾਲ ਤਾਂ ਦਵਾਈ ਦਾ ਰੈਂਟ ਜ਼ਿਆਦਾ ਲੈ ਲੈਂਦੀ ਸੀ ਕਈ ਵਾਰ ਤਾਂ ਉਹ ਦਵਾਈ ਦੀ ਕੰਪਨੀ ਵੀ ਚੇਂਜ ਕਰ ਦਿੰਦੇ ਸੀਗੇ ਮਰੀਜ਼ ਨੂੰ ਨਹੀਂ ਪਤਾ ਲੱਗਦਾ ਸੀਗਾ ਪਰ ਹੁਣ ਇਹ ਦਵਾਈ ਜਿਹੜੀ ਹਸਪਤਾਲਾਂ ਦੇ ਵਿੱਚ ਮਿਲਣ ਕਰਕੇ ਨਾਲੇ ਤਾਂ ਫਰੀ ਮਿਲਦੀ ਹੈ ਨਾਲੇ ਡੋਕ ਵੀ ਨਾਲੇ ਇਹਦੇ ਨਾਲ ਮਰੀਜ਼ ਦਾ ਵੀ ਟਾਈਮ ਬਚਦਾ ਗਾ ਅਤੇ ਨਾਲੇ ਉਹਦੀ ਜੇਬ ਵੀ ਬਚਦੀ ਹੈਗੀ ਅਤੇ ਜਿਹੜੇ ਕਰੋਨਾ ਦੀ ਗੱਲ ਕਰ ਰਹੇ ਉਹਦੇ ਬਾਰੇ ਵਿੱਚ ਇਹ ਹੈ ਕਿ ਵਿਚਾਰ ਕਿ ਉਸ ਟਾਈਮ ਬਹੁਤ ਮਾੜਾ ਦੌਰ ਸੀ ਇਸ ਦੁਨੀਆਂ 'ਤੇ ਅਤੇ ਇਹਦੇ ਨਾਲ ਬਹੁਤ ਸਾਰੇ ਮਰੀਜ਼ਾਂ ਦੀਆਂ ਵੀ ਡੈੱਥ ਹੋ ਗਈ ਬਿਨਾਂ ਇਲਾਜ ਤੋਂ ਅਤੇ ਕਈ ਵਾਰ ਤਾਂ ਡਾਕਟਰ ਵੀ ਇਸ ਟਾਈਮ 'ਚ ਬਹੁਤ ਡਰਦੇ ਸਨ ਅਤੇ ਇਸ ਨਾਲ ਲੋਕਾਂ ਨੂੰ ਭੁੱਖੇ ਵੀ ਰਹਿਣਾ ਪਿਆ ਕਈਆਂ ਨੂੰ ਵੀ ਬਾਹਰ ਜਾਣ 'ਤੇ ਪਾਬੰਦੀ ਲਗਾਈ ਗਈ ਸੀਗੀ ਅਤੇ ਉਹਨਾਂ ਨੂੰ ਆਪਣੀ ਇਹ ਭੁੱਖੇ ਰਹਿਣਾ ਪਿਆ ਬਿਹਤਰ ਲਈ ਇਹ ਮੰਗ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਹਸਪਤਾਲ ਲਗਭਗ ਹਰੇਕ ਪਿੰਡ ਵਿੱਚ ਖੋਲ੍ਹਿਆ ਜਾਵੇ ਅਤੇ ਇਹਦੇ ਵਿੱਚ ਡਾਕਟਰਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਡਾਕਟਰ ਕਈ ਵਾਰ ਸਰਕਾਰੀ ਹਸਪਤਾਲ 'ਚ ਹੋਰ ਬਿਮਾਰੀ ਨਾਲ ਰਿਲੇਟਡ ਹੁੰਦਾ ਹੋਰ ਕੋਰਸ ਨਾਲ ਰਿਲੇਟਡ ਹੁੰਦਾ ਗਾ ਪਰ ਦਵਾਈ ਆ ਜਿਹੜੀ ਹੋਰ ਚੀਜ਼ ਦੀ ਦਈ ਜਾਂਦਾ ਅਤੇ ਇਸ ਨਾਲ ਲੈਣਾ ਬਹੁਤ ਲੰਬੀਆਂ ਲੱਗ ਜਾਂਦੀਆਂ ਨੇਗੀਆਂ ਅਤੇ ਕਈ ਤਾਂ ਟਾਈਮਿੰਗ ਵੀ ਘੱਟ ਹੁੰਦੀ ਆ ਹਸਪਤਾਲਾਂ ਦੀ ਅਤੇ ਉਹਨਾਂ ਨੂੰ ਕਈ ਮਰੀਜ਼ਾਂ ਨੂੰ ਤਾਂ ਵਾਪਸ ਜਾਣਾ ਪੈਂਦਾ ਅਤੇ ਉਹਨਾਂ ਦਾ ਬਹੁਤ ਮੁਸ਼ਕਿਲ ਹੈ ਇਸ ਕਰਕੇ ਇਹੀ ਮੰਗ ਕਰਦੇ ਹਾਂ ਕਿ ਹਸਪਤਾਲ ਇੱਥੇ ਡਾਕਟਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਖੁ ਹਸਪਤਾਲ ਖੋਲ੍ਹੇ ਜਾਣ ਅਤੇ ਡਾਕਟਰਾਂ ਦੀਆਂ ਅਸਾਮੀਆਂ ਪੂਰੀਆਂ ਕਰਾਈਆਂ